ਸਤਿ ਸ਼੍ਰੀ ਅਕਾਲ ਕੱਲ੍ਹ ਮੈਂ ਸਿਲੰਡਰ ਬੁੱਕ ਕਰਵਾਇਆ ਸੀ ਪਰ ਮੇਰਾ ਰਸੋਈ ਵਿੱਚ ਲੱਗਾ ਸਿਲੰਡਰ ਖਤਮ ਹੋ ਗਿਆ ਸੀ ਖਾਣਾ ਬਣਾਉਣ ਲਈ ਤੰਗੀ ਆ ਰਹੀ ਸੀ ਸਾਡੇ ਗਵਾਂਢੀਆਂ ਦੇ ਕੋਲ ਸਲੰਡਰ ਵਾਧੂ ਪਿਆ ਸੀ ਅਸੀਂ ਉਹਨਾਂ ਨੂੰ ਪੁੱਛਿਆ ਕਿ ਸਲੰਡਰ ਦੇਣ ਨੂੰ ਤਿਆਰ ਹੋ ਉਹਨਾਂ ਨੇ ਕਿਹਾ ਕਿ ਤੁਸੀਂ ਸਲੰਡਰ ਲੈ ਸਕਦੇ ਹੋ ਅਸੀਂ ਉਹਨਾਂ ਕੋਲੋਂ ਸਲੰਡਰ ਲੈ ਲਿਆ ਅਤੇ ਅਸੀਂ ਹੁਣ ਸਲੰਡਰ ਸਾਨੂੰ ਸਲੰਡਰ ਦੀ ਜ਼ਰੂਰਤ ਨਹੀਂ ਹੈ ਸਾਡੇ ਸਲੰਡਰ ਦੀ ਬੁਕਿੰਗ ਰੱਦ ਕੀਤੀ ਜਾਵੇ ਮੇਰਾ ਬੁਕਿੰਗ ਨੰਬਰ ਜੀਰੋ ਚਾਰ ਸੱਤ ਨੌਂ ਹੈ ਅਤੇ ਕਿਰਪਾ ਕਰਕੇ ਇਸ ਨੰਬਰ ਦੀ ਬੁਕਿੰਗ ਨੂੰ ਰੱਦ ਕੀਤਾ ਜਾਏ ਮੈਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ